ਸਤਿ ਸ਼੍ਰੀ ਅਕਾਲ ਸਰ ਮੈਂ ਗਗਨਪ੍ਰੀਤ ਕੌਰ ਪਠਾਨਕੋਟ ਦੀ ਰਹਿਣ ਵਾਲੀ ਹਾਂ ਅਤੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਇੱਕ ਮਹੀਨਾ ਪਹਿਲਾਂ ਚਿਤਰਕਾਰੀ ਦਾ ਕੋਰਸ ਸ਼ੁਰੂ ਕੀਤਾ ਸੀ ਅਤੇ ਜਿਹਦੇ ਵਿੱਚ ਮੈਂ ਬਹੁਤ ਕੁਛ ਨਿਆ ਸਿੱਖਿਆ ਨਵੀਂ ਨਵੀਂ ਟਿਪਸ ਸਿੱਖੀਆਂ ਅਤੇ ਨਵੇਂ ਨਵੇਂ ਤਰੀਕਿਆਂ ਦੇ ਨਾਲ ਦੋ ਰੰਗਾਂ ਨੂੰ ਮ ਮਿਕਸ ਕਰ ਕੇ ਅਤੇ ਇੱਕ ਨਵਾਂ ਰੰਗ ਬਣਨਾ ਸਿੱਖਿਆ ਅਤੇ ਜਿਸ ਵਿੱਚ ਟੀਚਰ ਵੀ ਬਹੁਤ ਸ ਚੰਗੇ ਸੀ ਜਿਹਨਾਂ ਨੇ ਮੈਨੂੰ ਬੜੇ ਪਿਆਰ ਨਾਲ ਪੇਂਟਿੰਗ ਸਿਖਾਈ ਅਤੇ ਮੈਂ ਇਹ ਜਾਣ ਕੇ ਮੈਨੂੰ ਬਹੁਤ ਕ ਖੁਸ਼ੀ ਆ ਕਿ ਮੇਰੀ ਟੀਚਰਸ ਬਹੁਤ ਜ਼ਿਆਦਾ ਵਧੀਆ ਸੀ ਅਤੇ ਮੈਂ ਇਹਦੇ ਵਿੱਚ ਆਰਟ ਐਂਡ ਕਰਾਫਟ ਸਿੱਖੀ ਅਤੇ ਨਵੇਂ ਨਵੇਂ ਫਰੇਮ ਬਣਾਉਣਾ ਸਿੱਖੇ ਅਤੇ ਪੇਂਟਿੰਗ ਕਰਨੀ ਸਿੱਖੀ ਅਤੇ ਕੁਛ ਨੇਚਰ ਵਾਲੇ ਪੇਂਟਿੰਗ ਕਰਨੀ ਸਿੱਖੀ ਅਤੇ ਕੁਛ ਡਿਟੋ ਚੀਜ਼ਾਂ ਬਣਾਉਣੀਆ ਵੀ ਸਿੱਖੀਆਂ ਅਤੇ ਨਵੇਂ ਨਵੇਂ ਟ੍ਰਿਕਸ ਦੇ ਨਾਲ ਮੈਂ ਮਤਲਬ ਕਿ ਚੀਜ਼ਾਂ ਬਣਾਉਣੀਆਂ ਸਿੱਖੀਆਂ ਅਤੇ ਫੈਸ਼ਨ ਡਿਜਾਇੰਗ ਦਾ ਵੀ ਉਹਨਾਂ ਨੇ ਮੈਨੂੰ ਸਿਖਾਇਆ ਅਤੇ ਕੋਨਕੇ ਪੇਂਟਿੰਗ ਉਹਨਾਂ ਨੇ ਮੈਨੂੰ ਸਿਖਾਈ ਅਤੇ ਉਦਾਂ ਦੇ ਉਹਨਾਂ ਦੇ ਸਟਾਫ ਅਤੇ ਟੀਚਰ ਬਹੁਤ ਵਧੀਆ ਸੀ ਅਤੇ ਮੈਨੂੰ ਇਹ ਵੀ ਖੁਸ਼ੀ ਹੋਏਗੀ ਕਿ ਮੈਂ ਅਗਲੀ ਵਾਰ ਵੀ ਇਹਨਾਂ ਕੋਲੋਂ ਸਿੱਖਾਂ ਅਤੇ ਨਵੇਂ ਨਵੇਂ ਚੀਜ਼ਾਂ ਸਿੱਖ ਕੇ ਮੈਨੂੰ ਵੀ ਆਪਣੇ ਆਪ ਨੂੰ ਬਹੁਤ ਖੁਸ਼ੀ ਮਿਲ ਰਹੀ ਆ ਅਤੇ ਮੈਂ ਨਵੀਂ ਨਵੀਂ ਚੀਜ਼ਾਂ ਸਿੱਖਣਾ ਚਾਹੁੰਦੀ ਹਾਂ ਅਤੇ ਮੈਂ ਅਗਲੀ ਵਾਰ ਵੀ ਤੁਹਾਡੇ ਕੋਲ ਕਲਾਸ ਲੈਣਾ ਸ਼ੁਰੂ ਕਰਾਂਗੀ ਧੰਨਵਾਦ